ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਖੇਡਾਂ ਹਨ ਜਿਵੇਂ ਫੁੱਟਬਾਲ ਬੈਡਮਿੰਟਨ ਹਾਕੀ ਕਬੱਡੀ ਐਂਡ ਵੋਲੀਬੋਲ ਇਹ ਖੇਡਾਂ ਬਹੁਤ ਹੀ ਜ਼ਿਆਦਾ ਮਹੱਤਵ ਰੱਖਦੀਆਂ ਹਨ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਹਰੇਕ ਖੇਡ ਖੇਡਣੀ ਚਾਹੀਦੀ ਹੈ ਖੇਡਾਂ ਖੇਡਣ ਦੇ ਨਾਲ ਉਨ੍ਹਾਂ ਦੇ ਜੀਵਨ 'ਤੇ ਬਹੁਤ ਹੀ ਪ੍ਰਭਾਵ ਪੈਂਦਾ ਹੈ ਖੇਡਾਂ ਖੇਡਣ ਦੇ ਨਾਲ ਇੱਕ ਪੋਜਟਿਵ ਪ੍ਰਭਾਵ ਪੈਂਦਾ ਹੈ ਅਤੇ ਉਨ੍ਹਾਂ ਦੀ ਮਾਨਸਿਕ ਤਣਾਅ ਵੀ ਠੀਕ ਰਹਿੰਦਾ ਹੈ ਖੇਡਾਂ ਬਹੁਤ ਹੀ ਜ਼ਿਆਦਾ ਵਧੀਆ ਪ੍ਰਭਾਵ ਪਾਉਂਦੀਆਂ ਹਨ ਹਰੇਕ ਬੱਚੇ 'ਤੇ ਹਰ ਇੱਕ ਬੱਚੇ ਨੂੰ ਛੋਟੇ ਹੁੰਦਿਆਂ ਤੋਂ ਹੀ ਛੋਟੀਆਂ ਛੋਟੀਆਂ ਖੇਡਾਂ ਖੇਡਣੀਆਂ ਸਟਾਟ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਦੇ ਵਿੱਚ ਇੱਕ ਹੁਨਰ ਬਣਿਆ ਰਹੇ ਅਤੇ ਇੱਕ ਖੇਡ ਨੂੰ ਖੇਡਣ ਦੇ ਨਾਲ ਨਾਲ ਉਨ੍ਹਾਂ ਦੇ ਵਿੱਚ ਮਾਨਸਿਕ ਤਣਾਅ ਵੀ ਘੱਟਦਾ ਰਹੇ ਅਤੇ ਵਿਕਾਸ ਸਰੀਰ ਦਾ ਵਿਕਾਸ ਵੀ ਵੱਧਦਾ ਰਹੇ ਖੇਡਾਂ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ ਹਰ ਇੱਕ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਖੇਡਾਂ ਖੇਡਣ ਦੇ ਨਾਲ ਦਿਮਾਗ ਤੋਂ ਸਟਰੈੱਸ ਵੀ ਘੱਟਦਾ ਹੈ ਅਤੇ ਹਰ ਇੱਕ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹੁਸ਼ਿਆਰ ਹੋਣਾ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਵਿਦਿਆਰਥੀ ਦੇ ਲਈ ਇਕੱਲੀ ਪੜ੍ਹਾਈ ਹੀ ਜ਼ਿਆਦਾ ਮਹੱਤਵਪੂਰਨ ਨਹੀਂ ਰੱਖਦੀ ਖੇਡਾਂ ਵੀ ਬਹੁਤ ਇੰਪੋਟੈਂਟ ਹਨ